ਹੈਲੋ ਆਈਲੈਟਸ ਸੈਂਟਰ ਤੋਂ ਗੱਲ ਕਰ ਰਹੇ ਹੋ ਮੈਮ ਅਸੀਂ ਅਂ ਕੋਰਸਾਂ ਬਾਰੇ ਪੁੱਛਣਾ ਸੀ ਜੀ ਤੁਹਾਡੇ ਕਿਹੜੇ ਕਿਹੜੇ ਕੋਰਸ ਤੁਸੀਂ ਕਰਵਾਉਂਦੇ ਹੋ ਮਤਲਬ ਕਿੰਨੇ ਕਿੰਨੇ ਟੈਮ ਦੇ ਕੋਰਸ ਤੁਸੀਂ ਕਰਵਾਉਂਦੇ ਆਈਲੈਟਸ ਦੇ ਅੱਛਾ ਮੈਮ ਕਿੰਨੀ ਜੂਨ ਤੋਂ ਸਟਾਰਟ ਹੋਣ ਵਾਲਾ ਅੱਛਾ ਜੀ ਤੁਸੀਂ ਠੀਕ ਹੈ ਜੀ ਤੁਸੀਂ ਕੇ ਅਂ ਕਿੰਨੇ ਕਿੰਨੇ ਟੈਮ ਦੇ ਕੋਰਸ ਕਰਵਾ ਰਹੇ ਹੋ ਕੀ ਤੁਸੀਂ ਸੱਤ ਬੈਂਡ ਤੱਕ ਸਾਡੀ ਪ੍ਰੈਕਟਿਸ ਕਰਵਾ ਸਕਦੇ ਹੋ ਠੀਕ ਹੈ ਮੈਮ ਔਰ ਜਿਹੜੇ ਕੋਰਸ ਦੀ ਫ਼ੀਸ ਆ ਉਹ ਕਿੰਨੀ ਕਿੰਨੀ ਆ ਜੇ ਆਪਾਂ ਆਇਲਸ ਕਰਦੇ ਤਾਂ ਆਇਲਸ ਦੀ ਕਿੰਨੀ ਫ਼ੀਸ ਆ ਔਰ ਪੀ ਟੀ ਏ ਦੀ ਕਿੰਨੀ ਆ ਠੀਕ ਹੈ ਜੀ ਤਾਂ ਅਸੀਂ ਕਦੋਂ ਵਿਜ਼ਿਟ ਕਰ ਸਕਦੇ ਮੈਮ ਇੱਕ ਤਰੀਕ ਤੋਂ ਪਹਿਲਾਂ ਅਸੀਂ ਡੈਮੋ ਕਲਾਸ ਲਗਾ ਸਕਦੇ ਜਦੋਂ ਕਿ ਤੁਸੀਂ ਆਪਣਾ ਐਡਰੈਸ ਦਿਓਗੇ ਮੈਮ ਠੀਕ ਹੈ ਜੀ ਠੀਕ ਹੈ ਮੈਮ ਥੈਂਕਯੂ ਜੀ ਠੀਕ ਹੈ ਠੀਕ ਹੈ ਮੈਮ ਥੈਂਕ ਠੀਕ ਹੈ ਮੈਮ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਅਂ ਜਲਦੀ ਹੀ ਮਿਲਾਂਗੇ ਮੈਮ ਅ ਅਜੀਤ ਰੋਡ ਬਠਿੰਡਾ ਠੀਕ ਹੈ ਥੈਂਕਯੂ ਮੈਮ